ਭਾਰਤ ਵਿੱਚ ਘੁੰਮਣ ਫਿਰਨ ਨੂੰ ਕਾਫੀ ਥਾਵਾਂ ਹਨ ਕਈ ਧਾਰਮਿਕ ਥਾਵਾਂ ਹਨ ਜੋ ਸਾਡੇ ਗੁਰੂਆਂ ਨਾਲ ਸੰਬੰਧ ਰੱਖਦੀਆਂ ਹਨ ਕਈ ਇਤਿਹਾਸਿਕ ਥਾਵਾਂ ਵੀ ਹਨ ਜੋ ਸਾਡੇ ਸੱਭਿਆਚਾਰ ਬਾਰੇ ਦੱਸਦੀਆਂ ਹਨ ਜਿਵੇਂ ਭਾਰਤ ਵਿੱਚ ਤਾਜ ਮਹਿਲ ਇੱਕ ਅਜੂਬਾ ਹੈ ਜਿਸ ਨਾਲ ਭਾਰਤ ਨੂੰ ਜਾਣਿਆ ਜਾਂਦਾ ਹੈ ਦਿੱਲੀ ਦਾ ਲਾਲ ਕਿਲ੍ਹਾ ਵੀ ਇਤਿਹਾਸ ਵਿੱਚ ਖਾਸ ਮਹੱਤਵ ਰੱਖਦਾ ਹੈ ਕਈ ਗੁਰਦੁਆਰੇ ਹਨ ਜਿਵੇਂ ਨੰਦੇੜ ਵਿੱਚ ਹਜੂਰ ਸਾਹਿਬ ਅੰਮ੍ਰਿਤਸਰ ਸਾਹਿਬ ਵਿੱਚ ਹਰਿਮੰਦਰ ਸਾਹਿਬ ਪਟਨਾ ਸਾਹਿਬ ਅਨੰਦਪੁਰ ਸਾਹਿਬ ਕਾਫੀ ਇਤਿਹਾਸਿਕ ਗੁਰਦੁਆਰੇ ਹਨ ਜੋ ਸਾਨੂੰ ਸਾਡੇ ਗੁਰੂਆਂ ਬਾਰੇ ਦੱਸਦੇ ਹਨ